ਪੜ੍ਹਿਆ ਲਿਖਿਆ ਹੋਣਾ ਬੰਦੇ ਨੂੰ ਜ਼ਰੂਰੀ ਹੈ ਜੀ ਕਿਉਂ ਅੱਜ ਦੇ ਯੁੱਗ ਵਿੱਚ ਠੀਕ ਹੈ ਜੀ ਬਹੁਤ ਜ਼ਰੂਰੀ ਹੈ ਜੀ ਪੜ੍ਹਨਾ ਲਿਖਣਾ ਪੜ੍ਹਨਾ ਲਿਖਣਾ ਅਤੇ ਇਸ ਕਰਕੇ ਜੀ ਮੈਂ ਛੋਟਾ ਹੁੰਦਾ ਵਾਹੀ ਦੇ ਕੰਮ 'ਚ ਪੈ ਗਿਆ ਸੀ ਮੈਂ ਪੜ੍ਹਿਆ ਨਹੀਂ ਆ ਜ਼ਿਆਦਾ ਅਤੇ ਪੜ੍ਹਿਆ ਨਹੀਂ ਅਕਸਰ ਅਤੇ ਉਹਦਾ ਕਾਰਨ ਹੁਣ ਬਹੁਤ ਮੁਸ਼ਕਲਾਂ ਆਉਂਦੀਆਂ ਠੀਕ ਹੈ ਤਾਂ ਕਰਕੇ ਜੀ ਅਤੇ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਜੀ ਕਿਉਂ ਕਿਸੇ ਦੁਕਾਨ ਵਗੈਰਾ 'ਤੇ ਵੀ ਜਾਣਾ ਕੋਈ ਵੀ ਸਮਾਨ ਖਰੀਦਣਾ ਉਹਦੇ ਡੇਟ ਦਾ ਪਤਾ ਲੱਗ ਜਾਂਦਾ ਵੀ ਸਹੀ ਆ ਇਹ ਡੇਟ ਆ ਕਿ ਗਲਤ ਆ ਇਸ ਬਾਰੇ ਅਤੇ ਹੋਰ ਵੀ ਯਾਨੀ ਕਿ ਜਿਹੜੇ ਮੇਰੇ ਨਾਲ ਦੇ ਵੀ ਛੋਟੇ ਛੋਟੇ ਹੁੰਦੇ ਸੀ ਇਕੱਠੇ ਖੇਡਦੇ ਉਹ ਮੇਰੇ ਨਾਲੋਂ ਪੜ੍ਹ ਸੀਗੇ ਠੀਕ ਹੈ ਜੀ ਮੈਂ ਪੜ੍ਹਿਆ ਨਹੀਂ ਗਾ ਉਹ ਪੜ੍ਹ ਗਏ ਸੀਗੇ ਜਿਹੜੇ ਅਤੇ ਅੱਜ ਵਧੀਆ ਜੋਬਾਂ ਕਰ ਰਹੇ ਆ ਅਤੇ ਪਰਿਵਾਰ ਦੇ ਵਿੱਚ ਖੁਸ਼ ਰਹਿ ਰਹੇ ਆ ਅਤੇ ਅਣਪੜ੍ਹ ਬੰਦਾ ਤਾਂ ਬਸ ਐਵੇਂ ਆ ਜਮ੍ਹਾ ਠੀਕ ਹੈ ਉਹਦੀ ਕੋਈ ਜਮ੍ਹਾ ਕੋਈ ਹੈ ਨਹੀਂ ਅਤੇ ਕਿਉਂ ਪੜ੍ਹਨਾ ਲਿਖਣਾ ਜ਼ਰੂਰੀ ਹੈ ਜੀ ਜੇ ਪੜ੍ਹੇ ਹੁੰਦੇ ਤਾਂ ਕੋਈ ਨਾ ਕੋਈ ਕਿਸੇ ਮੁਕਾਮ 'ਤੇ ਪਹੁੰਚੇ ਹੁੰਦੇ ਠੀਕ ਹੈ ਜੀ ਅਤੇ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਆ ਜੀ ਸਭ ਤੋਂ ਜ਼ਿਆਦਾ ਤਾਂ ਪਹਿਲਾਂ ਜੀ ਠੀਕ ਹੈ ਜੀ ਕੋਈ ਵੀ ਕ ਸਾਰੇ ਬ ਹੁਣ ਪੜ੍ਹਾਈ ਦੇ ਯੁੱਗ ਹੀ ਆ ਚਾਰ ਚੁਫੇਰੇ ਹੁਣ ਮੋਬਾਈਲਾਂ 'ਤੇ ਹੀ ਸਾਰਾ ਕੁਛ ਹੁੰਦਾ ਜੀ ਮੋਬਾਈਲਾਂ 'ਤੇ ਹੀ ਬੰਦਾ ਸਮਝਦਾ ਮੋਬਾਈਲਾਂ 'ਤੇ ਕੀ ਕੁਝ ਨਹੀਂ ਸਾਰਾ ਕੁਛ ਮੋਬਾਇਲਾਂ 'ਤੇ ਹੀ ਹੋ ਗਿਆ ਜੀ ਪੜ੍ਹਾਈ ਨੇ ਹੀ ਸਬੰਧਿਤ ਹੋ ਗਿਆ ਸਾਰਾ ਕੁਝ ਜੀ ਅਣਪੜ੍ਹ ਤਾਂ ਬੰਦਾ ਇੱਕ ਜੀਰੋ ਹੋ ਗਿਆ ਜਮ੍ਹਾ ਠੀਕ ਹੈ ਜੀ ਅਤੇ ਪੜ੍ਹਿਆ ਲਿਖਿਆ ਜ਼ਰੂਰੀ ਹੈ ਜੀ ਕਿਉਂ ਮੋਬਾਇਲ 'ਤੇ ਹੀ ਹੁਣ ਸਾਰਾ ਕੁਝ ਕੋਈ ਵੀ ਐਪ ਕੱਢਣਾ ਕਿਸੇ ਬਾਰੇ ਵੀ ਕੋਈ ਚੀਜ਼ ਵਕਤ ਵੇਖਣਾ ਜਾਂ ਕਿਸੇ ਬਾਰੇ ਵੀ ਜਿਵੇਂ ਖੇਤੀਬਾੜੀ ਸੰਦਾਂ ਬਾਰੇ ਕੋਈ ਲੈਣਾ ਕਰਨਾ ਵੀ ਉਹ ਬੰਦਾ ਮੋਬਾਇਲ 'ਤੇ ਭਰ ਕੇ ਹੀ ਉਹ ਕਰ ਸਕਦਾ ਵੇਖ ਸਕਦਾ ਜੀ ਠੀਕ ਹੈ ਜੀ ਸਾਰੇ ਕੁਝ ਵੀ ਕਿਹੋ ਜਿਹਾ ਕਿੱਥੋਂ ਮਿਲੂਗਾ ਕੀ ਕਿਹੇ ਜਿਹੀ ਚੀਜ਼ ਹੈ ਕਿਹੇ ਜਿਹੀ ਕੁਆਲਿਟੀ ਦੀ ਆ ਕਿਹੜਾ ਕਿਹੜਾ ਕ ਕਿਹੜੇ ਕਿਹੜੇ ਇਹਨਾਂ ਦੇ ਮਤਲਬ ਕਿ ਵਿੱਚ ਕਿਹੜੀ ਕਿਹੜੀ ਕੌਪਨੀ ਦੇ ਇਹਦੇ ਵਿੱਚ ਮਤਲਬ ਕਿ ਸਮਾਨ ਪਾਇਆ ਹੋਇਆ ਗਾ ਇਸ ਤਰ੍ਹਾਂ ਸਾਰਾ ਕੁਛ ਯਾਨੀ ਕਿ ਪੜ੍ਹਿਆ ਲਿਖਿਆ ਹੀ ਬੰਦਾ ਜਾਣ ਸਕਦਾ ਗਾ ਅਤੇ ਕਿਉਂ ਪੜ੍ਹਿਆ ਲਿਖਿਆ ਹੋਣਾ ਇਸ ਕਰਕੇ ਜ਼ਰੂਰੀ ਆ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ